ਹੈਲੋ ਹਾਂਜੀ ਦਲਜਿੰਦਰ ਸਿੰਘ ਜੀ ਹਾਂਜੀ ਹਾਂਜੀ ਸਰ ਹੋਰ ਕਿਵੇਂ ਹੋ ਹੋਰ ਬਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੇ ਵਧੀਆ ਜੀ ਆਪਣੇ ਸੁਣਾਓ ਘਰ ਬਾਲ ਬੱਚੇ ਕਿੱਦਾਂ ਜੀ ਸਰ ਚਲੋ ਸਤਿਗੁਰ ਸਤਿਗੁਰ ਦੀ ਕਿਰਪਾ ਹੀ ਚਾਹੀਦੀ ਹੈ ਜੀ ਕੰਮ ਕਾਰ ਜੀ ਤੁਹਾਨੂੰ ਪਤਾ ਹੀ ਹੈ ਜੀ ਬਸ ਚੱਲੀ ਜਾਂਦੇ ਟਾਈਮ ਪਾਸ ਹਾਂਜੀ ਹਾਂਜੀ ਅਤੇ ਸਰ ਇੱਕ ਤੁਹਾਡੇ ਤੋਂ ਜਾਣਕਾਰੀ ਲੈਣੀ ਸੀਗੀ ਤੁਹਾਨੂੰ ਤਾਂ ਫੋਨ ਲਾਇਆ ਸੀ ਹੁਣ ਤੁਹਾਨੂੰ ਪਤਾ ਹੀ ਹ ਵੀ ਆਪਣਾ ਬੱਚਾ ਵੀ ਹੁਣ ਤਿੰਨ ਚਾਰ ਸਾਲ ਦਾ ਹੋ ਗਿਆ ਜੀ ਅਤੇ ਉਹਨੂੰ ਨਾ ਉਹਨੂੰ ਅਸੀਂ ਸਕੂਲ 'ਚ ਲਗਾਉਣਾ ਆਪਾਂ ਅਤੇ ਨਾ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਕਿਹੜੇ ਸਕੂਲ ਲਾਈਏ ਆਪਣੇ ਮੁਕਤਸਰ 'ਚ ਕਿਹੜੇ ਕਿਹੜੇ ਵਧੀਆ ਸਕੂਲ ਆ ਵੀ ਜਿਨ੍ਹਾਂ ਦੀ ਜਿਨ੍ਹਾਂ ਇਹ ਨਾ ਜੀ ਦੋਨਾਂ ਬਾਰੇ ਚੱਲ ਜੇ ਹੈ ਨਾ ਵੀ ਪੜ੍ਹਾਈ ਕਿੱਥੇ ਵਧੀਆ ਹੋ ਰਹੀ ਹੈ ਅਤੇ ਉਹ ਹਿਸਾਬ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਸਰ ਆਪਾਂ ਨੂੰ ਨਾ ਇੰਨਾਂ ਇੱਕ ਨਾ ਜੀ ਥੋੜ੍ਹੀ ਜਿਹੀ ਫੀਸ ਵੀ ਥੋੜ੍ਹੀ ਮਿਨੀਮਮ ਜਿਹੀ ਹੋਣੀ ਚਾਹੀਦੀ ਆ ਤੁਹਾਨੂੰ ਪਤਾ ਹੀ ਆਪਣੇ ਕੰਮ ਕਾਰ ਦੇ ਹਿਸਾਬ ਨਾਲ ਵੀ ਉੰਨੇ ਉੰਨੇ 'ਚ ਰੇਂਜ 'ਤੇ ਆਪਣਾ ਵੇਖੋ ਕੋਈ ਸਕੂਲ ਜੇ ਆਪਣਾ ਵੀ ਜੇ ਅੱਜ ਕੱਲ੍ਹ ਉਂਝ ਪਤਾ ਲੱਗਿਆ ਸੀ ਕਹਿੰਦੇ ਅੱਜ ਕੱਲ੍ਹ ਸਰਕਾਰੀ 'ਚ ਵੀ ਵਧੀਆ ਮਾਹੌਲ ਚੱਲ ਰਿਹਾ ਪਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਆਪਣਾ ਆਪਣੇ ਬੱਚੇ ਕਿੱਥੇ ਲੱਗੇ ਕਿਹੜੇ ਸਕੂਲ 'ਚ ਲੱਗੇ ਹੈ ਜੀ ਅੱਛਾ ਅੱਛਾ ਪ੍ਰਾਈਵੇਟ ਕਿਹੜੇ ਸਕੂਲ 'ਚ ਜੀ ਹਾਂਜੀ ਹਾਂਜੀ ਉਹ ਤਾਂ ਠੀਕ ਹੈ ਜੀ ਪਰ ਨਾ ਪਤਾ ਤਾਂ ਹੁੰਦਾ ਹੀ ਹੈ ਮੰਨ ਕੇ ਚੱਲੋ ਵੀ ਆਪਣਾ ਵੀ ਬੱਚੇ ਪੜ੍ਹ ਕੇ ਆਏ ਆ ਵੀ ਪੜ੍ਹਾਈ ਆ ਜੀ ਕਿਹੋ ਜਿਹੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਜੀ ਹੁਣ ਤੁਹਾਨੂੰ ਪਤਾ ਹੀ ਆ ਹੁਣ ਵੱਡੇ ਭਾਈ ਸਾਹਿਬ ਤੋਂ ਪੁੱਛਾਂਗੇ ਵੀ ਕੀ ਕਿਵੇਂ ਕਿਵੇਂ ਨਹੀਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚੱਲੋ ਠੀਕ ਹੈ ਜੀ ਫਿਰ ਹਾਂਜੀ ਹਾਂਜੀ ਹਾਂਜੀ ਮੈਂ ਹਾਂਜੀ ਮੈਂ ਤੁਹਾਨੂੰ ਸ਼ਾਮ ਮੈਂ ਤੁਹਾਨੂੰ ਸ਼ਾਮ ਨੂੰ ਫੋਨ ਲਗਾਉਂਦਾ ਜੀ ਫਿਰ ਠੀਕ ਹੈ ਜੀ ਤੁਸੀਂ ਪੁੱਛ ਕੇ ਠੀਕ ਹੈ ਠੀਕ ਹੈ ਜੀ